ਹਾਂਜੀ ਮੈਂ ਇਸ ਕੋਰਸ ਐੱਮ ਕੇ ਵੀ ਆਈ ਕੋਰਸ ਰਾਹੀਂ ਆਪਣੇ ਹੁਨਰ ਨੂੰ ਬਿਹਤਰ ਬਣਾਉਣ ਲਈ ਉਤਸੁਕ ਹਾਂ ਅਤੇ ਮੈਂ ਇਹ ਕੋਰਸ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਹੁਨਰ ਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਥੈਂਕ ਯੂ